ਕਿਸੇ ਵੀ ਚੀਜ਼ ਨੂੰ ਸਿੱਖਣ ਤੋਂ ਪਹਿਲਾਂ ਸਾਨੂੰ ਉਸਦੀ ਜਾਣਕਾਰੀ ਹੋਣੀ ਚਾਹੀਦੀ ਹੈ ਜਿਵੇਂ ਅਸੀਂ ਭੰਗੜਾ ਜਾਂ ਐਰੋਬਿਕਸ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਬਾਰੇ ਪਤਾ ਹੋਣਾ ਚਾਈਦਾ ਹੈ ਕਿ ਇਨ੍ਹਾਂ ਨੂੰ ਕਰਨ ਲਈ ਇੱਕ ਫੁਰਤੀਲਾ ਸਰੀਰ ਹੋਣਾ ਚਾਹੀਦਾ ਹੈ ਜਦੋਂ ਵੀ ਅਸੀਂ ਇਸਨੂੰ ਸ਼ੁਰੂ ਕਰਨਾ ਹੈ ਤਾਂ ਅਸੀਂ ਆਪਣੇ ਸਰੀਰ ਦੀ ਸਮਰੱਥਾ ਦੇ ਮੁਤਾਬਕ ਹੀ ਕਰਨਾ ਹੈ ਡਾਈਟ ਚੰਗੀ ਹੋਣੀ ਚਾਹੀਦੀ ਹੈ ਜਦੋਂ ਵੀ ਇਸ ਭੰਗੜੇ ਨੂੰ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਘੱਟ ਖਾਣਾ ਪੀਣਾ ਚਾਹੀਦਾ ਹੈ ਥੋੜ੍ਹਾ ਥੋੜ੍ਹਾ ਕਰਕੇ ਭੰਗੜੇ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜੰਕ ਫ਼ੂਡ ਨਾ ਖਾਓ ਖੁਸ਼ੀ ਅਤੇ ਉਤਸ਼ਾਹ ਦੇ ਨਾਲ ਪੂਰੀ ਕੰਸਿਸਟੈਂਸੀ ਦੇ ਨਾਲ ਇਸਨੂੰ ਕਰੋ ਕਿਸੇ ਵੀ ਚੀਜ਼ ਨੂੰ ਸਿੱਖਣ ਲਈ ਸਾਨੂੰ ਪੂਰਾ ਕੰਸਨਟ੍ਰੇਟ ਹੋਣਾ ਚਾਹੀਦਾ ਹੈ ਸ਼ਰਾਬ ਸਿਗਰੇਟਨੋਸ਼ੀ ਇਨ੍ਹਾਂ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਥਕਾਵਟ ਆਉਂਦੀ ਹੈ ਇਸ ਲਈ ਇਸ ਵਿੱਚ ਸ ਕੁਝ ਗੈਪ ਪਾ ਕੇ ਹੀ ਇਨ੍ਹਾਂ ਚੀਜ਼ਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ ਹੈ ਜਦੋਂ ਜਿਵੇਂ ਜਿਵੇਂ ਤੁਹਾਡਾ ਸਰੀਰ ਤੁਹਾਡੀ ਸਮਰੱਥਾ ਵਧਦੀ ਹੈ ਇਸਨੂੰ ਕਰਨ ਨੂੰ ਇਸਦੇ ਆਪਣੀ ਸਮਰੱਥਾ ਵਧਾਉਣੀ ਚਾਹੀਦੀ ਹੈ ਜੋ ਵੀ ਕੰਮ ਕਰਨਾ ਹੈ ਆਪਣੇ ਪੂਰੇ ਚਾਅ ਅਤੇ ਮਨ ਦੇ ਉਤਸ਼ਾਹ ਨਾਲ ਹੀ ਕਰਨਾ ਚਾਹੀਦਾ ਹੈ